ਮੈਂ ਚਿੱਤਰਕਾਰੀ ਬਣਾਉਣਾ ਆਪਣੇ ਵੱਡੇ ਭਰਾ ਤੋਂ ਸਿੱਖੀ ਉਸ ਉਹ ਪਹਿਲਾਂ ਚਿੱਤਰਕਾਰੀ ਬਣਾਉਂਦਾ ਸੀ ਮੈਂ ਉਸਦੇ ਉੱਤੇ ਹੱਸਦਾ ਹੁੰਦਾ ਸੀ ਵੀ ਤੂੰ ਕੀ ਬਣਾਉਂਦਾ ਹੈ ਪਰ ਮੈਨੂੰ ਉਹਦੇ ਸਿਨਰੀਆਂ ਦੇਖ ਕੇ ਮੇਰਾ ਵੀ ਮਨ ਕੀਤਾ ਵੀ ਮੈਂ ਵੀ ਬਣਾਵਾਂ ਸਿ ਮੈਂ ਵੀ ਚਿੱਤਰਕਾਰੀ ਬਣਾਵਾਂ ਫਿਰ ਇੱਕ ਦਿਨ ਮੈਂ ਬੈਠ ਕੇ ਆਪਣੀ ਚਿੱਤਰਕਾਰੀ ਬਣਾਈ ਅਤੇ ਉਹਨੂੰ ਦੱਸਿਆ ਉਸਨੇ ਮੈਨੂੰ ਸ਼ਾਬਾਸ਼ ਦਿੱਤੀ ਪਰ ਉਹ ਤੋਂ ਬਾਅਦ ਉਹ ਤੋਂ ਬਾਅਦ ਮੈਂ ਹੌਲੀ ਹੌਲੀ ਆਪਣੀ ਚਿੱਤਰੀਆਂ ਸਿਨਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਇਸ ਵਿੱਚ ਨਾਲ ਮੈਨੂੰ ਬਹੁਤ ਵੱਡਾ ਵਧੀਆ ਗਿਆਨ ਲੱਗਿਆ ਇਸ ਵਿੱਚ ਮੈਨੂੰ ਸ਼ਾਂਤੀ ਵੀ ਮਿਲੀ ਫਿਰ ਪਰ ਅੱਜ ਕੱਲ੍ਹ ਦੇ ਯੁੱਗ ਵਿੱਚ ਬੱਚੇ ਆਪਣੇ ਵੱਡੇ ਭਰਾ ਅਤੇ ਵੱਡੇ ਭਰਾ ਜਾਂ ਆਪਣੇ ਮਾਪਿਆਂ ਤੋਂ ਬਿਨਾਂ ਪੁੱਛੇ ਕਰ ਲੈਂਦੇ ਹਨ ਪਰ ਅੱਜ ਕੱਲ੍ਹ ਟੈਕਨੋਲੋਜੀ ਬਹੁਤ ਵੱਧ ਜ਼ਿਆਦਾ ਵੱਧ ਗਈ ਹੈ ਲੋਕ ਬੱਚੇ ਵੱਡੇ ਭਰਾ ਜਾਂ ਮਾਂ ਪਿਓ ਤੋਂ ਬਿਨਾਂ ਪੁੱਛੇ ਸਿਨਰੀਆਂ ਯੂਟੀਊਬ ਦੇ ਉੱਤੇ ਸਰਚ ਕਰ ਲੈਂਦੇ ਹਨ ਅਤੇ ਉਹਤੋਂ ਦੇਖ ਦੇਖ ਬਣਾ ਲੈਂਦੇ ਹਨ ਇਹ ਇੱਕ ਬਹੁਤ ਵੱਡਾ ਗਿਆਨ ਹੈ ਚਿੱਤਰਕਾਰੀ ਸਾਡੀ ਸਿਹਤ ਸਾਡੀ ਵਧੀਆ ਸਾਨੂੰ ਸਾਨੂੰ ਵਧੀਆ ਦਿ ਸ਼ਿਕਸ਼ਾ ਦਿੰਦੀ ਹੈ ਚਿੱਤਰਕਾਰੀ ਇੱਕ ਅਜਿਹੀ ਚਿੱਤਰ ਹੈ ਜਿਹਦੇ ਵਿੱਚ ਆਪਣਾ ਕੋਨਫੀਡੈਂਸ ਲੈਵਲ ਵੱਧਦਾ ਹੈ ਕਿ ਆਪਾਂ ਹੋਰ ਨਵੀਆਂ ਨਵੀਆਂ ਚੀਜ਼ਾਂ ਬਣਾ ਕੇ ਅਧਿਆਪਕ ਜਾਂ ਵੱਡੇ ਮੈਂਬਰਾਂ ਨੂੰ ਦਿਖਾ ਕੇ ਆਪਣੀ ਚਿੱਤਰਕਾਰੀ ਅਦਾ ਕਰ ਸਕਦੇ ਹਾਂ ਇਸ ਵਿੱਚ ਕਈ ਬੱਚੇ ਵ ਬਹੁਤ ਵਧੀਆ ਬਣਾ ਚਿੱਤਰਕਾਰੀ ਹਨ ਅਤੇ ਮੇਰੇ ਮੁਹੱਲੇ ਵਿੱਚ ਵੀ ਬਹੁਤ ਵਧੀਆ ਵਧੀਆ ਬੱਚੇ ਚਿੱਤਰਕਾਰੀ ਬਣਾਉਂਦੇ ਹਨ